ਮੈਂ ਰਿਵਾਇਤੀ ਤੌਰ 'ਤੇ ਪੈਨ ਨਾਲ ਲਿਖਣਾ ਹੀ ਪਸੰਦ ਕਰਦੀ ਹਾਂ ਕਿਉਂਕਿ ਮੁ ਮੈਨੂੰ ਪੈਨ ਨਾਲ ਹੀ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ ਪਰ ਸਮਾਂ ਸਮਾਜ ਬਦਲ ਰਿਹਾ ਹੈ ਉਸ ਨਾਲ ਸਾਨੂੰ ਲੈਪਟਾਪ ਔਰ ਮੋਬਾਈਲ ਚਲਨ ਵਿੱਚ ਆ ਗਏ ਹਨ ਅਤੇ ਲੈਪਟੋਪ ਮੋਬਾਈਲ ਨਾਲ ਹੁਣ ਸਭ ਲੋਕ ਟਾਈਪ ਕਰਦੇ ਹਨ ਇਸ ਲਈ ਸਮੇਂ ਦੇ ਨਾਲ ਨਾਲ ਸਾਨੂੰ ਲੈਪਟੋਪ ਅਤੇ ਮੋਬਾਈਲ ਦਾ ਯੂਸ ਵੀ ਕਰਨਾ ਚਾਹੀਦਾ ਹੀ ਹੈ ਕਿਉਂਕਿ ਉਸ ਨਾਲ ਅਸੀਂ ਆਪਦੇ ਆਪਦੇ ਮੈਸੇਜ਼ ਨੂੰ ਬਹੁਤ ਦੂਰ ਬੈਠੇ ਲੋਕਾਂ ਤੱਕ ਆਰਾਮ ਨਾਲ ਪਹੁੰਚਾ ਸਕਦੇ ਹਾਂ ਪਰ ਪਰ ਦੇਖਿਆ ਜਾਵੇ ਤਾਂ ਮੈਨੂੰ ਕਾਗਜ਼ 'ਤੇ ਪੈਨ ਨਾਲ ਲਿਖਣਾ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਉਹ ਸਾਡੀ ਬਹੁਤ ਵਧੀਆ ਪ੍ਰੈਕਟਿਸ ਕਰਦੇ ਹਨ ਅਤੇ ਨਾਲੇ ਸਾਡੇ ਹੱਥਾਂ ਦੀ ਐਕਸਰਸਾਈਜ਼ ਵੀ ਹੁੰਦੀ ਹੈ ਉਸ ਨਾਲ ਪਰ ਪਰ ਸਮੇਂ ਦਾ ਬਦਲਣਾ ਜ਼ਰੂਰੀ ਹੈ ਹਾਲ ਦੇ ਸਾਲਾਂ ਵਿੱਚ ਲਿਖਣਾ ਬਹੁਤ ਬਦਲ ਗਿਆ ਹੈ ਕਿਉਂਕਿ ਜੋ ਲੈਪਟੋਪ ਅਤੇ ਮੋਬਾਈਲ ਦਾ ਕੰਮ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ ਕਿਉਂਕਿ ਹਰ ਜਗਾਂ 'ਤੇ ਕੰਮ ਇਹ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਸਾਨੂੰ ਇਹਨਾਂ ਲੈਪਟਾਪ ਅਤੇ ਮੋਬਾਈਲ ਦੀ ਸਹਾਇਤਾ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਸ 'ਤੇ ਇਸ 'ਤੇ ਅਸੀਂ ਐਪਸ ਨਾਲ ਬਹੁਤ ਵਧੀਆ ਬਣੇ ਬਣਾਏ ਟੈਸਟ ਸੀਰੀਜ਼ ਲੈ ਸਕਦੇ ਹਾਂ ਅਤੇ ਬੱਚਿਆਂ ਲਈ ਬਣਾ ਸਕਦੇ ਹਾਂ ਇਸ ਨੇ ਸਾਡਾ ਕੰਮ ਬਹੁਤ ਸੌਖਾ ਕਰ ਦਿੱਤਾ ਹੈ ਇਸ ਲਈ ਇਹ ਸਾਡੇ ਲਈ ਬਹੁਤ ਜ਼ਰੂਰੀ ਵੀ ਹਨ ਇਸ ਲਈ ਲਿਖਣ ਦਾ ਚਲਨ ਥੋੜ੍ਹਾ ਬਦਲ ਗਿਆ ਹੈ